ਮੇਰੇ ਖਿਆਲ ਵਿੱਚ ਆਉਣ ਵਾਲੇ ਸਾਲਾਂ ਵਿੱਚ ਬਹੁਤ ਸਾਰੇ ਉਪਯੋਗ ਵਿੱਤੀ ਖੋਜਾਂ ਦਾ ਸਭ ਤੋਂ ਵੱਡਾ ਪ੍ਰਭਾਵ ਪਵੇਗਾ ਜਿਵੇਂ ਕਿ ਵਿਆਜ ਦਰਾਂ 'ਚ ਤਬਦੀਲੀ ਜੇਕਰ ਕੇਂਦਰੀ ਬੈਂਕ ਵਿਆਜ ਦਰਾਂ ਵਧਾਉਂਦੇ ਹਨ ਤਾਂ ਲੋਨ ਮਹਿੰਗੇ ਹੋ ਜਾਣਗੇ ਜਿਸ ਨਾਲ ਉਦੋਗਿਕ ਵਿਕਾਸ ਉੱਤੇ ਅਸਰ ਪੈ ਸਕਦਾ ਹੈ ਘੱਟ ਵਿਆਜ ਦਰਾਂ ਹੋਣ ਨਾਲ ਨਿਵੇਸ਼ ਵੱਧ ਸਕਦਾ ਹੈ ਜਿਵੇਂ ਕਿ ਮੂਲ ਬਾਜ਼ਾਰ ਅਤੇ ਨਿਵੇਸ਼ਕ ਭਰੋਸਾ ਹੋ ਸਕਦੇ ਹਨ ਜੇਕਰ ਸ਼ੇਅਰ ਮਾਰਕੀਟ ਅਸਥਿਰ ਰਹਿੰਦੀ ਹੈ ਤਾਂ ਨਵੇਂ ਉਦਯੋਗਾਂ ਲਈ ਫੰਡ ਇਕੱਤਰ ਕਰਨਾ ਮੁਸ਼ਕਿਲ ਹੋ ਸਕਦਾ ਹੈ ਨਿਵੇਸ਼ਕ ਭਰੋਸਾ ਵਧੇਗਾ ਤਾਂ ਨਵੀਆਂ ਕੰਪਨੀਆਂ ਨੂੰ ਵਧਣ ਦਾ ਮੌਕਾ ਮਿਲੇਗਾ ਮੁਦਰਾ ਸਫਲਤਾ ਵੀ ਹੋ ਸਕਦੀ ਹੈ ਜੇਕਰ ਮੁਦਰਾ ਸਫਲਤਾ ਵੱਧਦੀ ਹੈ ਤਾਂ ਉਤਪਾਦਨ ਦੀ ਲਾਗਤ ਮਜਦੂਰੀ ਅਤੇ ਉਪਭੋਗਤਾ ਖਰਚ 'ਚ ਵਾਧੂ ਹੋ ਸਕਦੀ ਹੈ ਜੇਕਰ ਇਹ ਕੰਟਰੋਲ 'ਚ ਰਹਿੰਦੀ ਹੈ ਤਾਂ ਖਰੀਦਦਾਰੀ ਸ਼ਕਤੀ ਬਣੀ ਰਹੇਗੀ ਤਕਨੀਕੀ ਵਿਕਾਸ ਵੀ ਆਨ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਨਵੀਆਂ ਤਕਨੀਕਾਂ ਉਦਯੋਗ ਦੀ ਕਾਰਗੁਜ਼ਾਰੀ 'ਚ ਵੱਡਾ ਬਦਲਾਅ ਲਿਆ ਸਕਦੀਆਂ ਹਨ ਟੈਕਨੋਲੋਜੀ ਅਪੋ ਅਡੋਪਸ਼ਨ ਹੌਲੀ ਹੋਵੇ ਤਾਂ ਕੰਪਨੀਆਂ ਪਿੱਛੇ ਰਹਿ ਸਕਦੀਆਂ ਹਨ ਜੇਕਰ ਆਯਾਤ ਨਿਰਯਾਤ ਨੀਤੀਆਂ ਹੋ ਸਕਦੀਆਂ ਹਨ ਮਹਿੰਗੀਆਂ ਟਰੈਫਿਕ ਮ ਮਹਿੰਗੀਆ ਟੈਰਿਫ ਜਾਂ ਨਵੇਂ ਆਯਾਤ ਨਿਯਮ ਕੁਛ ਉਦਯੋਗਾਂ ਉੱਤੇ ਪ੍ਰਭਾਵ ਪਾ ਸਕਦੇ ਹਨ ਅੰਤਰਰਾਸ਼ਟਰੀ ਮੰਗ ਘੱਟ ਹੋਣ ਨਾਲ ਨਿਰਯਾਤ ਅਧਾਰਤ ਉਦਯੋਗ ਮੁਸ਼ਕਿਲ 'ਚ ਆ ਸਕਦੀ ਹੈ ਜੇਕਰ ਤੁਸੀਂ ਦੱਸੋ ਕਿ ਕਿਸ ਖੇਤਰ 'ਚ ਫਾਇਨੈਂਸ ਆਈ ਟੀ ਮੈਨੂੰਫੈਕਚਰਿੰਗ ਐਗਰੀਕਲਚਰ ਹੈਲਥ ਕਰਨ ਵਿੱਚ ਹੋਏ ਤਾਂ ਮੈਂ ਹੋਰ ਵਿਸ਼ਲੇਸ਼ਣ ਕਰ ਸਕਦੀ ਹਾਂ